ਆਵਾਜਾਈ ਦਾ ਮਤਲਬ ਆਦਮੀ ਅਤੇ ਜੀ ਸਾਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਹੈ ਜੋ ਸਾਧਨ ਮਨੁੱਖ ਅਤੇ ਚੀਜ਼ਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਕੇ ਤੁਰ 'ਤੇ ਲੈ ਜਾਣ ਉਸਨੂੰ ਸਹਾਈ ਹੁੰਦੇ ਹਨ ਜਿਵੇਂ ਕਿ ਥਲ ਆਵਾਜਾਈ ਜਲ ਆਵਾਜਾਈ ਹਵਾਈ ਆਵਾਜਾਈ ਪਾਈਪਲਾਈਨ ਆਵਾਜਾਈ